ਪੰਜ ਤਰੀਕਾਂ ਹਨ ਜੋ ਮੈਨੂੰ ਯਾਦ ਨੇ ਉਹ ਹਨ ਤੇਰ੍ਹਾਂ ਅਗਸਤ ਦੋ ਹਜ਼ਾਰ ਪੰਜ ਗਿਆਰਾਂ ਮਈ ਉੱਨੀ ਸੌ ਚੁਹੱਤਰ ਅਠਾਈ ਅਪ੍ਰੈਲ ਉੱਨੀ ਸੌ ਛਿਹੱਤਰ ਦਸ ਨਵੰਬਰ ਦੋ ਹਜ਼ਾਰ ਅੱਠ ਇੱਕ ਜਨਵਰੀ ਦੋ ਹਜ਼ਾਰ ਚਾਰ